ਪੰਜਾਬ ਵਿੱਚ ਕਿੱਤਾ ਮੁਖੀ ਸਿਖਲਾਈ ਜਾਂ ਹੁਨਰ ਵਿਕਾਸ ਦੇ ਬਹੁਤ ਮੌਕੇ ਉਪਲਬਧ ਹਨ ਉਹ ਵੱਖ ਵੱਖ ਚੀਜ਼ਾਂ ਦਾ ਉਪਯੋਗ ਦੀ ਲੋੜਾਂ ਨੂੰ ਪੂਰਾ ਕਰਦੇ ਹਨ ਜਿਵੇਂ ਕਿ ਖੇਤੀਬਾੜੀ ਨਿਰਮਾਣ ਆਈ ਟੀ ਯੂਨੀਵਰਸਿਟੀਜ਼ ਹੋਰ ਬਹੁਤ ਟ੍ਰੇਨਿੰਗ ਹੈਗੀਆਂ ਹੁੰਦੀਆਂ ਹਨ ਜੋ ਕਿ ਪੰਜਾਬ ਦੇ ਬਹੁਤ ਹੀ ਮਦਦ ਕਰਦੇ ਹੈ ਪੰਜਾਬ ਦੇ ਲੋਕਾਂ ਨੂੰ ਕਿ ਪੰਜਾਬ ਦੀ ਅਗਰ ਇੱਕ ਨੋਰਮਲ ਫੈਮਿਲੀ ਦੀ ਗੱਲ ਕਰ ਲਈਏ ਤਾਂ ਪੰਜਾਬ ਵਿੱਚ ਜ਼ਿਆਦਾਤਰ ਖੇਤੀਬਾੜੀ ਹੁੰਦੀ ਆ ਅਤੇ ਛੋਟੀ ਉਮਰ ਤੋਂ ਹੀ ਇੱਕ ਬੱਚਾ ਜੋ ਹੁੰਦਾ ਆ ਉਹ ਆਪਣੇ ਪਿਤਾ ਜੀ ਦੀ ਮਦਦ ਕਰਦਾ ਹੈ ਇਸ ਦਾ ਮਤਲਬ ਹੈ ਕਿ ਪੰਜਾਬ ਦੇ ਲੋਕਾਂ ਦੇ ਖੂਨ ਵਿੱਚ ਹੀ ਮਦਦ ਕਰਨਾ ਹੈ ਉਹ ਹਮੇਸ਼ਾ ਹੀ ਬਹੁਤ ਹੀ ਪਿਆਰ ਨਾਲ ਰਹਿੰਦੇ ਹਨ ਇਸ ਕਰਕੇ ਉਹ ਆਪਣੇ ਵੱਡਿਆਂ ਤੋਂ ਸਿੱਖਦੇ ਹਨ ਅਤੇ ਉਹਨਾਂ ਦਾ ਆਦਰ ਕਰਦੇ ਹਨ ਅਤੇ ਜਿੱਦਾਂ ਜਿੱਦਾਂ ਬੱਚਾ ਵੱਡਾ ਹੁੰਦਾ ਜਾਂਦਾ ਹੈ ਉਹ ਕਿਸੇ ਨਾ ਕਿਸੇ ਸਕੂਲ ਪੈਂਦਾ ਹੈ ਸਕੂਲ ਵਿੱਚ ਜਿਹੜੇ ਅਧਿਆਪਕ ਹੁੰਦੇ ਹਨ ਉਹ ਬੱਚੇ ਨੂੰ ਬਹੁਤ ਹੀ ਪਿਆਰ ਨਾਲ ਟਰੀਟ ਕਰਦੇ ਹਨ ਬਹੁਤ ਹੀ ਸ ਮਤਲਬ ਕਿ ਵਧੀਆ ਤਰੀਕੇ ਨਾਲ ਰੱਖਦੇ ਹਨ ਉਹ ਤੋਂ ਬਾਅਦ ਫਿਰ ਜਦ ਬੱਚਾ ਦਸਵੀਂ ਪਾਸ ਕਰ ਜਾਂਦਾ ਹੈ ਉਹ ਤੋਂ ਬਾਅਦ ਆਪਣੀ ਕਲਾਸ ਰੱਖਣੀ ਹੁੰਦੀ ਹੈ ਉਹ ਗਿਆਰਵੀਂ ਬਾਰਵੀਂ ਵਿੱਚ ਉਹਨਾਂ ਨੂੰ ਅਸੀਂ ਦਿਖਾਉਂਦੇ ਹਨ ਕਿ ਤੁਹਾਡੇ ਲਈ ਇੰਨਾ ਕੁਛ ਹੈ ਕਰਨ ਦੇ ਲਈ ਕਿਉਂਕਿ ਪੰਜਾਬ ਬ ਪੰਜਾਬੀ ਲੋਕ ਬਹੁਤ ਹੀ ਹੋਣਹਾਰ ਹੁੰਦੇ ਹਨ ਅਤੇ ਬਹੁਤ ਤੇਜ਼ ਹੁੰਦੇ ਹਨ ਅਤੇ ਉਹ ਆਪਣੇ ਟਰੱਸਟ ਦੀਆਂ ਚੀਜ਼ਾਂ ਜਿੰ ਜਿਸ ਚੀਜ਼ਾਂ 'ਚੋਂ ਉਹ ਅੱਗੇ ਵਧਣਾ ਚਾਹੁੰਦੇ ਉਸ ਚੀਜ਼ਾਂ ਨੂੰ ਬਹੁਤ ਜਲਦੀ ਪਹਿਚਾਣ ਜਾਂਦੇ ਹਨ ਅਤੇ ਉਹ ਅੱਗੇ ਵੱਧ ਜਾਂਦੇ ਹਨ ਫੇਰ ਪੰਜਾਬ ਦੇ ਲੋਕ ਜਦ ਆਪਣੀ ਪੜ੍ਹਾਈ ਖਤਮ ਕਰ ਲੈਂਦੇ ਹਨ ਮਤਲਬ ਕਿ ਮਾਸਟਰਸ ਕਰ ਲੈਂਦੇ ਆ ਜਾਂ ਆਪਣੀ ਪੜ੍ਹਾਈ ਨੂੰ ਅੱਗੇ ਵਧਾਈ ਜਾਂਦੇ ਹਨ ਕਿ ਉਹ ਸਭ ਤੋਂ ਵਧੀਆ ਨਾਲੇਜ ਹੋਣ ਪਰ ਜਿਹੜੇ ਲੋਕ ਇੰਨੇ ਕਾਬਲ ਨਹੀਂ ਹੁੰਦੇ ਜਿਹੜੇ ਮਤਲਬ ਕਿ ਇੱਕ ਡਿਗਰੀ ਲੈ ਕੇ ਰੱਖ ਜਾਂਦੇ ਹਨ ਉਹ ਵੀ ਕਿੱਥੇ ਪਿੱਛੇ ਨਹੀਂ ਰਹਿੰਦੇ ਉਹ ਕੋਈ ਨਾ ਕੋਈ ਕੰਮ ਕਰਨਾ ਸ਼ੁਰੂ ਕਰਦੇ ਹਨ ਜਿਹਦੇ ਵਿੱਚ ਉਹ ਪੰਜਾਬ ਦੇ ਲੋਕਾਂ ਦੀ ਮਦਦ ਕਰਦੇ ਹੈ ਹਰ ਦਿਨ ਪੰਜਾਬ ਜੋ ਅੱਗੇ ਵੱਧਦਾ ਹੈ ਹਰ ਦਿਨ ਕੋਈ ਨਾ ਕੋਈ ਇੱਕ ਨਵੀਂ ਡਿਸਕਵਰੀ ਕਰਦਾ ਹੈ ਕੋਈ ਨਾ ਕੋਈ ਨਵੀਂ ਚੀਜ਼ ਖੋਜ ਕਰਦਾ ਹੈ ਇਸ ਕਰਕੇ ਪੰਜਾਬ ਹਰ ਦਿਨ ਅੱਗੇ ਵੱਧਦਾ ਹੈ ਪੰਜਾਬੀ ਇੱਥੇ ਤੱਕ ਹੀ ਨਹੀਂ ਰੁਕਦੇ ਉਹ ਆਪਣੇ ਪੰਜਾਬੀ ਦੇਸ਼ ਨੂੰ ਵਧਾਉਣ ਦੇ ਨਾਲ ਨਾਲ ਦੂਜੇ ਦੇਸ਼ਾਂ 'ਚ ਵੀ ਜਾਂਦੇ ਹਨ ਦੂਜੇ ਮੁਲਕਾਂ 'ਚ ਜਾਂਦੇ ਹਨ ਉੱਥੇ ਦੀ ਵੀ ਮਦਦ ਕਰਦੇ ਹਨ ਕਿਉਂਕਿ ਸਾਡੇ ਖੂਨ ਵਿੱਚ ਹੀ ਮਦਦ ਕਰਨਾ ਹੈ ਇਸ ਕਰਕੇ ਅਸੀਂ ਉਹਨਾਂ ਦੀ ਵੀ ਮਦਦ ਕਰਦੇ ਹਨ ਅਤੇ ਪੰਜਾਬੀ ਖੁਦ ਤਾਂ ਅੱਗੇ ਵੱਧਦੇ ਹਨ ਪਰ ਹੱਥ ਫੜ ਕੇ ਅੱਗੇ ਨੂੰ ਵੀ ਅੱਗੇ ਵਧਾਉਂਦੇ ਹਨ ਜਿੰਨੀ ਲਾਈਫ ਇੱਕ ਪੰਜਾਬੀ ਲੋਕਾਂ ਦੀ ਆਸਾਨ ਹੁੰਦੀ ਆ ਉਹ ਚਾਹੁੰਦੇ ਹਨ ਕਿ ਉਹ ਸਭ ਦੀ ਲਾਈਫ ਇੰਨੀ ਆਸਾਨ ਕਰ ਸਕਣ ਹਰ ਇੱਕ ਚੀਜ਼ ਨੂੰ ਉਹ ਸਮਝਦੇ ਹਨ ਜਿਹੜੇ ਲੋਕ ਬਹੁਤ ਪੁੱਠੇ ਸੋਚਦੇ ਹੈ ਜਿਹੜੇ ਬੱਚੇ ਬਹੁਤ ਪੁੱਠੇ ਸੋਚਦੇ ਹਨ ਉਹ ਸਾਇੰਸ ਡਿਪਾਰਟਮੈਂਟ ਨੂੰ ਆਪਣਾ ਬਣਾਉਂਦੇ ਹਨ ਉਹਦੇ ਅੱਗੇ ਪੜ੍ਹਾਈ ਕਰਦੇ ਹਨ ਅਤੇ ਨਵੀਆਂ ਨਵੀਆਂ ਡਿਸਕਵਰੀਆਂ ਕਰਦੇ ਹਨ ਜੋ ਕਿ ਪੂਰੇ ਦੇਸ਼ 'ਚ ਬਹੁਤ ਮਦਦ ਕਰਦੀਆਂ ਹਨ ਅਤੇ ਪੰਜਾਬ ਦੇ ਦੀ ਲੋਕਾਂ ਦੀ ਪੰਜਾਬ ਦੇ ਲੋਕਾਂ ਲਈ ਕੋਈ ਹੁਨਰ ਦੀ ਕਮੀ ਨਹੀਂ ਹੈ ਉਹ ਹਰ ਇੱਕ ਸਟੇਜ ਵਿੱਚ ਜਾ ਕੇ ਕੁਛ ਨਿਰਾਲਾ ਕਰਕੇ ਦਿਖਾਉਂਦੇ ਹਨ ਧੰਨਵਾਦ